ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਦੱਸੋ ਅੱਛਾ ਚੱਲ ਠੀਕ ਹੈ ਸਰ ਠੀਕ ਹੈ ਹੋਰ ਸੁਣਾਓ ਕਿਵੇਂ ਹੋ ਹਾਂਜੀ ਹਾਂਜੀ ਬਿਲਕੁਲ ਸਰ ਬਿਲਕੁਲ ਠੀਕ ਸਭ ਸਭ ਠੀਕ ਤੁਸੀਂ ਦੱਸੋ ਹਾਂ ਕੀ ਸੇਵਾ ਕਰ ਸਕਦਾ ਮੈਂ ਤੁਹਾਡੀ ਯੈਸ ਸਰ ਠੀਕ ਹੈ ਪਹਿਲਾਂ ਤੁਸੀਂ ਇਸ ਤੋਂ ਪਹਿਲਾਂ ਕਿੱਥੇ ਚਲਾ ਕੇ ਨਹੀਂ ਦੇਖਿਆ ਕਿੱਥੇ ਕਿਸੇ ਕੋਲ ਹੋਵੇ ਘਰ ਦੇ ਵਿੱਚ ਠੀਕ ਹੈ ਬੇਸਿਕ ਚੀਜ਼ਾਂ ਤੁਹਾਨੂੰ ਪਤਾ ਹੀ ਹੋਣਗੀਆਂ ਜਿਵੇਂ ਕੰਪਿਊਟਰ ਦੇ ਵਿੱਚ ਇੱਕ ਤਾਂ ਆਪਣੀ ਡਿਸਪਲੇ ਹੋ ਗਈ ਜੋ ਜਿਸ ਨੂੰ ਆਪਾਂ ਮੋਨੀਟਰ ਕਹਿ ਦਿੰਦੇ ਹਾਂ ਠੀਕ ਹੈ ਸਰ ਇਸ ਤੋਂ ਬਾਅਦ ਜੋ ਆਪਣਾ ਸੀ ਪੀ ਯੂ ਆ ਗਿਆ ਜਿਹਦੇ ਵਿਚ ਜਿਹਨੇ ਕੇ ਸਾਰਾ ਕੰਮ ਆਪਾਂ ਨੂੰ ਕਰਕੇ ਦੇਣਾ ਕੰਪਿਊਟਰ ਦਾ ਠੀਕ ਸਰ ਉਸ ਤੋਂ ਬਾਅਦ ਮਾਊਸ ਹੋ ਗਿਆ ਸਭ ਤੋਂ ਵਧੀਆ ਤੁਹਾਨੂੰ ਮਾਊਸ ਆਪਾਂ ਲਿਆ ਕੇ ਦਿੱਤਾ ਤਾਂ ਕਿ ਤੁਹਾਨੂੰ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਠੀਕ ਹੈ ਸਰ ਕੀਬੋਰਡ ਦੇ ਵਿੱਚ ਵੈਸੇ ਤਾਂ ਕਾਫ਼ੀ ਜਿਵੇਂ ਵਰਾਇਟੀ ਆਉਂਦੀ ਹੈ ਬਟ ਜਿਵੇਂ ਤੁਸੀਂ ਕਿ ਟਾਈਪਿੰਗ ਦਾ ਕਹਿ ਰਹੇ ਸੀਗੇ ਉਸ ਦਿਨ ਕੀ ਤੁਹਾਨੂੰ ਟਾਈਪਿੰਗ ਦੀ ਲੋੜ ਪਵੇਗੀ ਤਾਂ ਇਹਦੇ ਵਿੱਚ ਤੁਹਾਨੂੰ ਮਕੈਨਿਕਲ ਕੀਬੋਰਡ ਜੋ ਹੁੰਦੇ ਨੇ ਉਹ ਸਭ ਤੋਂ ਵਧੀਆ ਰਹੇਗਾ ਤੁਹਾਨੂੰ ਉਹਨਾਂ ਦੀ ਇੱਕ ਤਾਂ ਕੁਆਲਿਟੀ ਬਹੁਤ ਅੱਛੀ ਹੁੰਦੀ ਹੈ ਅਤੇ ਕਾਫ਼ੀ ਲੰਬੇ ਟਾਈਮ ਤੱਕ ਜਿਵੇਂ ਤੁਸੀਂ ਯੂਜ ਕਰੋਗੇ ਤਾਂ ਲੰਬੇ ਟਾਈਮ ਤੱਕ ਕੀਬੋਰਡ ਚੱਲੇਗਾ ਵੈਸੇ ਤਾਂ ਅੱਜ ਦੇ ਟਾਈਮ 'ਤੇ ਵਾਇਰਲੈਸ ਹੀ ਜ਼ਿਆਦਾ ਕੰਮ ਦੇ ਵਿੱਚ ਆ ਰਹੇ ਨੇ ਕਿਉਂਕਿ ਇਹਦੇ 'ਚ ਇਹ ਹੈ ਕਿ ਆਪਾਂ ਜੇ ਥੋੜ੍ਹਾ ਕੰਪਿਊਟਰ ਦੂਰ ਬੈਠ ਕੇ ਜੇ ਆਪਾਂ ਕੰਫਰਟੇਬਲਲੀ ਕੰਮ ਕਰਨਾ ਤਾਂ ਉਸ ਟਾਈਮ 'ਤੇ ਕੰਮ ਆਉਂਦੇ ਨੇ ਬਟ ਜੇ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਤੁਸੀਂ ਟਾਈਪਿੰਗ ਵਗੈਰਾ ਦਾ ਕੰਮ ਕਰਨਾ ਜਾਂ ਕੋਈ ਵੀ ਆਫਿਸ ਦਾ ਕੰਮ ਕਰਨਾ ਤਾਂ ਇਹਦੇ ਵਿੱਚ ਤੁਸੀਂ ਵਾਇਰ ਵਾਲਾ ਯੂਜ ਕਰੋਂਗੇ ਤਾਂ ਤੁਹਾਨੂੰ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਉਹਦੇ ਵਿੱਚ ਜੋ ਹੈ ਕਿਸ ਤਰ੍ਹਾਂ ਦਾ ਲੈਗ ਨਹੀਂ ਆਉਂਦਾ ਹੈਗਾ ਤੁਹਾਡਾ ਜੋ ਕੰਮ ਹੋਵੇਗਾ ਉਹ ਵੀ ਵਧੀਆ ਹੋਵੇਗਾ ਅਤੇ ਤੁਹਾਨੂੰ ਸਪੀਡ ਜੋ ਹੈ ਉਹ ਵੀ ਵਧੀਆ ਮਿਲੇਗੀ ਉਹਦੇ ਵਿੱਚ ਠੀਕ ਹੈ ਸਰ ਇਸ ਤੋਂ ਬਾਅਦ ਮੈਂ ਦੱਸ ਰਿਹਾ ਸੀਗਾ ਕਿ ਹੁਣ ਜਿਵੇਂ ਕਿ ਤੁਸੀਂ ਨਵਾਂ ਕੰਪਿਊਟਰ ਲਿਆ ਵਾ ਤੁਸੀਂ ਇੰਟਰਨੈਟ ਦਾ ਯੂਜ ਕਰੋਂਗੇ ਠੀਕ ਹੈ ਤਾਂ ਫਿਰ ਜਿਵੇਂ ਕਿ ਠੀਕ ਹੈ ਸਰ ਅਤੇ ਉਹਦੇ ਵਿੱਚ ਇਹ ਹੈ ਕਿ ਤੁਸੀਂ ਹੁਣ ਇੰਟਰਨੈਟ 'ਤੇ ਜਾਓਗੇ ਤਾਂ ਵਾਇਰਸ ਵਗੈਰਾ ਤੋਂ ਸੇਫਟੀ ਲਈ ਵੀ ਤੁਸੀਂ ਕਹੋ ਤਾਂ ਉਹਦੇ ਵਿੱਚ ਐਂਟੀ ਵਾਇਰਸ ਇੰਸਟਾਲ ਕਰਵਾ ਲਿਓ ਉਹਦੇ ਵਿੱਚ ਤਾਂ ਕਿ ਤੁਹਾਨੂੰ ਫਿਊਚਰ ਦੇ ਵਿੱਚ ਤੁਹਾਡਾ ਹਾਂ ਕੋਈ ਚੱਕਰ ਨਹੀਂ ਤੁਸੀਂ ਜਾਂ ਤਾਂ ਮੈਂ ਐਂ ਕਰਾਂਗਾ ਕਿ ਲੜਕਾ ਭੇਜ ਦਾਂਗਾ ਤੁਹਾਡੇ ਘਰ ਠੀਕ ਹੈ ਉਹ ਸਾਰਾ ਕੁਛ ਇੰਸਟਾਲ ਕਰਕੇ ਤੁਹਾਨੂੰ ਦੱਸ ਦੇਗਾ ਕਿ ਕਿਸ ਤਰ੍ਹਾਂ ਕਿਵੇਂ ਯੂਜ ਕਰਨਾ ਉਹਦਾ ਠੀਕ ਹੈ ਜੋ ਵੀ ਉਹਦੇ ਵਿੱਚ ਸੇਫਟੀ ਹੁੰਦੀ ਹੈ ਉਹਦਾ ਸਾਰਾ ਕੁਛ ਉਹ ਤਾਡੇ ਤੁਹਾਨੂੰ ਸਮਝਾ ਦੇਗਾ ਠੀਕ ਹੈ ਸਰ ਹੁਣ ਇਸਦੇ ਇਸ ਟਾਈਮ 'ਤੇ ਮਤਲਬ ਕਿ ਜੋ ਆਪਟੀਕਲ ਜੋ ਹੈ ਉਹ ਕਾਫ਼ੀ ਜ਼ਿਆਦਾ ਵਧੀਆ ਚੱਲ ਰਹੀ ਹੈ ਇਹਦੇ ਵਿੱਚ ਇਹ ਹੈ ਕਿ ਤੁਹਾਨੂੰ ਆ ਦੋ ਤਰ੍ਹਾਂ ਦੀ ਸਪੀਡ ਮਿਲ ਜਾਂਦੀ ਹੈ ਇੱਕ ਫਾਈਵ ਗੀਗਾਹਰਟ ਦੀ ਸਪੀਡ ਮਿਲ ਜਾਂਦੀ ਹੈ ਇੱਕ ਟੂ ਪੋਇੰਟ ਫਾਈਵ ਗੀਗਾਹਰਟ ਦੀ ਸਪੀਡ ਮਿਲ ਜਾਂਦੀ ਹੈ ਬਸ ਠੀਕ ਹੈ ਫਿਰ ਤੁਹਾਨੂੰ ਹਾਂ ਬਸ ਠੀਕ ਆ ਫਿਰ ਤਾਂ ਟੂ ਪੋਇੰਟ ਫਾਈਵ ਗੀਗਾਹਰਟ ਤਾਂ ਤੁਹਾਡੇ ਲਈ ਸਹੀ ਰਹੇਗਾ ਅਤੇ ਬਾਕੀ ਜਿਵੇਂ ਵੀ ਤੁਹਾਨੂੰ ਹੋਇਆ ਫਿਊਚਰ ਦੇ ਵਿੱਚ ਤੁਸੀਂ ਦੁਕਾਨ 'ਤੇ ਕਦੇ ਵੀ ਆਓ ਠੀਕ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਜੇ ਤੁਸੀਂ ਫੋਨ ਕਰਨਾ ਤੁਸੀਂ ਫੋਨ ਕਰੋ ਠੀਕ ਹੈ ਸਰ

ਹਾਂਜੀ ਹਾਂਜੀ ਬਿਲਕੁਲ ਸਰ ਸਟੋਰ 'ਤੇ ਠੀਕ ਓਕੇ ਸਰ ਸਤਿ ਸ਼੍ਰੀ ਅਕਾਲ ਜੀ